ਮੈਂ ਏਅਰਪੋਰਟ ਤੋਂ ਰੇਲਵੇ ਸਟੇਸ਼ਨ ਤੱਕ ਜਾਣਾ ਹੈ ਇਸ ਲਈ ਮੈਨੂੰ ਇੱਕ ਕੈਬ ਦੀ ਜ਼ਰੂਰਤ ਸੀ ਅਤੇ ਮੈਂ ਇੱਕ ਕੈਬ ਕੀਤੀ ਹੈ ਜੋ ਕਿ ਜੋ ਕਿ ਏਅਰਪੋਰਟ ਤੋਂ ਮੈਨੂੰ ਰੇਲਵੇ ਸਟੇਸ਼ਨ ਤੱਕ ਪਹੁੰਚਾ ਸਕੇ ਇਸ ਲਈ ਮੈਂ ਤੁਹਾਨੂੰ ਕਾਲ ਕੀਤਾ ਹੈ ਕਿ ਜੋ ਡਰਾਈਵਰ ਹੈ ਉਸ ਦਾ ਮੈਨੂੰ ਆ ਤੁਸੀਂ ਨੰਬਰ ਦੱਸ ਦਿਓ ਕਿ ਉਹ ਉਸਦੀ ਕੈਪ ਦਾ ਕੀ ਨੰਬਰ ਹੈ ਤਾਂ ਉਹ ਕਦੋਂ ਤੱਕ ਪਹੁੰਚੇਗਾ ਅਤੇ ਉਸ ਤੋਂ ਮੇਰੀ ਇਹ ਬੇਨਤੀ ਹੈ ਕਿ ਤੁਹਾਡਾ ਜੋ ਡਰਾਈਵਰ ਹੈ ਉਹ ਹੈ ਸਮੇਂ ਸਿਰ ਪਹੁੰਚ ਜਾਵੇ ਕਿਉਂਕਿ ਮੈਂ ਪਹਿਲਾਂ ਵੀ ਕੈਬ ਕੀਤੀ ਸੀ ਤਾਂ ਉਹ ਲੇਟ ਹੋ ਗਿਆ ਸੀ ਇਸ ਕਾਰਨ ਮੈਨੂੰ ਬਹੁਤ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਹੁਣ ਮੈਂ ਚਾਹੁੰਦੀ ਹਾਂ ਕਿ ਤੁਸੀਂ ਜੋ ਵੀ ਕੈਬ ਵਾਲਾ ਹੈ ਉਸਨੂੰ ਬੋਲ ਦਿਓ ਕਿ ਉਹ ਸਮੇਂ ਸਿਰ ਪਹੁੰਚ ਜਾਵੇ ਦੇਰ ਨਾ ਕਰੇ ਜੋ ਵੀ ਮੇਰੇ ਰੇਲਵੇ ਸਟੇਸ਼ਨ ਦੇ ਜਾਣ ਦੇ ਸਹੀ ਟਾਈਮ 'ਤੇ ਮੈਨੂੰ ਉਸਦਾ ਉਸਦਾ ਉਸਦਾ ਘਰ ਆਉਣਾ ਆਉਣੀ ਚਾਹੀਦੀ ਹੈ ਇਸ ਲਈ ਮੇਰੀ ਬੇਨਤੀ ਹੈ ਕਿ ਤੁਸੀਂ ਉਸਨੂੰ ਮੈਨੂੰ ਉਸਦਾ ਕੈਬ ਦਾ ਨੰਬਰ ਲਿਖਵਾ ਦਿਓ ਅਤੇ ਉਸ ਕੈਬ ਵਾਲੇ ਨੂੰ ਸਹੀ ਟਾਈਮ 'ਤੇ ਮੇਰੇ ਘਰ ਭੇਜ ਦੇਣਾ ਤਾਂ ਜੋ ਮੈਨੂੰ ਕਿਸੇ ਵੀ ਪਰੇਸ਼ਾਨੀ ਜਾਂ ਦਿਕਤ ਦਾ ਸਾਹਮਣਾ ਨਾ ਕਰਨਾ ਪਵੇ ਕੈਬ ਵਾਲਾ ਵਧੀਆ ਹੋਣਾ ਚਾਹੀਦਾ ਹੈ ਉਹ ਕਿਸੇ ਵੀ ਤਰ੍ਹਾਂ ਦਾ ਗਲਤ ਕੰਮ ਕਰਨ ਵਾਲਾ ਬੰਦਾ ਨਹੀਂ ਹੋਣਾ ਚਾਹੀਦਾ ਉਹ ਸਹੀ ਆਦਮੀ ਹੋਣਾ ਚਾਹੀਦਾ ਹੈ ਇਸ ਗੱਲ ਦਾ ਧਿਆਨ ਤੁਸੀਂ ਆਪ ਹੀ ਰੱਖਣਾ ਹੈ